ਪਿੰਡ ਇੱ ਪਿੰਡ ਅਜਿਹੇ ਥਾਂ ਹੁੰਦੀ ਹੈ ਜਿੱਥੇ ਮਨੁੱਖ ਆਬਾਦੀ ਜਾਂ ਵਸੋਂ ਵ ਵੱਡੇ ਝੰਡੇ ਵਿੱਚ ਰਹਿੰਦੀ ਹੈ ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਨ੍ਹਾਂ ਦੀ ਆਬਾਦੀ ਸੈਂਕੜਿਆਂ ਤੋਂ ਲੈ ਕੇ ਹਜ਼ਾਰਾਂ ਤੱਕ ਹੁੰਦੀ ਹੈ ਵਸੋਂ ਦੇ ਰਹਿਣ ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ 'ਤੇ ਕੱਚੇ ਘਰ ਜਾਂ ਪੱਕੇ ਹੁੰਦੇ ਨੇ ਇੱਥੇ ਦਾ ਕਿੱਤਾ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਵੀ ਹੁੰਦਾ ਹੈ ਮੈਂ ਝੁੱਗੀ ਝੋਂਪੜੀ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਬਹੁਤ ਹੀ ਨੀਵੇਂ ਪੱਧਰ ਦੀ ਰਿਹਾਇਸ਼ ਅਤੇ ਸਿਰ ਛੁਪਾਉਣ ਵਾਲੀ ਥਾਂ ਜਾਂ ਬਸਤੀਆਂ ਨੂੰ ਕਹਿੰਦੇ ਹਨ ਇਸ ਬਸਤੀਆਂ ਦੇ ਆਕਾਰ ਦੇਸ਼ ਦੇ ਮੁਕਾਬਲੇ ਵੱਖੋ ਵੱਖ ਹਨ ਇਹਨਾਂ ਝੁੱਗੀਆਂ ਝੋਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਬਿਜਲੀ ਪਾਣੀ ਲਈ ਸਾਫ਼ ਸੁਥਰੇ ਅਤੇ ਰਹਿਣ ਦੀਆਂ ਹੋਰ ਮੁੱਢਲੀ ਲੋੜਾਂ ਹਨ ਬੱਚਿਆਂ ਦੀ ਪੜ੍ਹਾਈ ਲਈ ਸਕੂਲਾਂ ਅਤੇ ਸਿਹਤ ਸਹੂਲਤਾਂ ਨਸੀਬ ਨਹੀਂ ਹੁੰਦੀਆਂ ਭਾਰਤ ਵਿੱਚ ਤਰਾਨਵੇਂ ਮਿਲੀਅਨ ਝੁੱਗੀ ਝੋਂਪੜੀਆਂ ਵਿੱਚ ਲੋਕ ਝੁੱਗੀ ਝੋਂਪੜੀਆਂ ਵਿੱਚ ਰਹਿੰਦੇ ਹਨ ਹਰ ਸ਼ਹਿਰ ਦੀ ਪੱਚੀ ਪ੍ਰਤੀ ਪ੍ਰਤੀਸ਼ਤ ਅੱਲਾਹ ਬਸਤੀਆਂ ਵਿੱਚ ਵਸੌਂਦੇ ਹਨ ਜਦੋਂਕਿ ਬੰਬਈ ਵਰਗੇ ਮਹਾਂਨਗਰ ਵਿੱਚ ਤਾਂ ਅੱਧ ਤੋਂ ਵੱਧ ਵਸੋਂ ਮਸਲ ਬਸਤੀਆਂ ਵਿੱਚ ਰਹਿੰਦੇ ਹਨ ਗੰਦੀਆਂ ਬਸਤੀਆਂ ਦੇ ਅੱਸੀ ਨੱਬੇ ਲੱਖ ਬੱਚੇ ਸਕੂਲ ਜਾਣ ਦੀ ਥਾਂ 'ਤੇ ਮਿਹਨਤ ਅਤੇ ਮਜ਼ਦੂਰੀ ਕਰਦੇ ਹਨ ਮਜ਼ਦੂਰੀ ਭਾਰਤ ਵਿੱਚ ਬਾਲ ਮਜ਼ਦੂਰੀ ਦੀ ਦਰ ਵਿਸ਼ਵ ਵਿੱਚ ਸਭ ਤੋਂ ਵੱਧ ਹੈ ਸ਼ਹਿਰਾਂ ਵਿੱਚ ਮਲਮ ਖੇਤਰ ਦੇ ਵਧਣ ਕਾਰਨ ਪਿੰਡਾਂ ਦੇ ਗਰੀਬ ਲੋਕਾਂ ਦਾ ਸ਼ਹਿਰਾਂ ਵੱਲ ਨੂੰ ਪ੍ਰਵੇਸ਼ ਕਰਨਾ ਜਿਸ ਦਾ ਮੁੱਖ ਕਾਰਨ ਪਿੰਡਾਂ ਵਿੱਚ